ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਜਿਹੜਾ ਭਾਰਤ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਕਰਨਾ ਪੈ ਰਿਹਾ ਲੋਕਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਆਉਂਦੀ ਹੈ ਪੜ੍ਹਾਈ ਦਾ ਹੈ ਨਾਂ ਵੀ ਪੜ੍ਹਾਈ ਦੇ ਲਈ ਤਾਂ ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਸਕੂਲਾਂ ਦੇ ਵਿੱਚ ਐਡੀਮੀਸ਼ਨਾਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਸੀਗੀਆਂ ਅਤੇ ਹੁਣ ਕੀ ਹੈ ਸਰਕਾਰ ਨੇ ਉਹਦੇ ਲਈ ਨਾ ਬਹੁਤ ਵਧੀਆ ਉਪਰਾਲੇ ਕੀਤੇ ਹੈ ਫਰੀ ਅ ਪੜ੍ਹਾਈ ਦਾ ਬੰਦੋੇਬਸਤ ਕਰ ਦਿੱਤਾ ਹੈ ਜਿਹੜੇ ਗਰੀਬ ਜਿਹੜੇ ਸ ਬੱਚੇ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਹੀ ਖਾਣਾ ਪੀਣਾ ਵੀ ਅ ਪ੍ਰਬੰਧ ਕਰ ਦਿੱਤਾ ਹੈ ਤਾਂ ਕਿ ਬੱਚੇ ਹੋਰ ਜ਼ਿਆਦਾ ਇਨਕਰੇਜ ਹੋਣ ਸਕੂਲ ਆਉਣ ਲਈ ਅਤੇ ਦੂਜਾ ਸੀਗਾ ਸਾਡੀ ਵਧਦੀ ਜਿਹੜੀ ਹੈ ਆ ਜਿਹੜੀ ਲੋਕਾਂ ਦੀ ਗਿਣਤੀ ਹੈ ਨਾ ਸਮਾਜ ਦੇ ਵਿੱਚ ਇੰਨੇ ਸਾਰੇ ਲੋਕਾਂ ਦੀ ਗਿਣਤੀ ਕਾਰਨ ਕਿਆ ਹੁੰਦਾ ਸੀਗਾ ਬੇਰੁਜ਼ਗਾਰੀ ਵਧਦੀ ਸੀਗੀ ਅਤੇ ਹੁਣ ਸਰਕਾਰ ਨੇ ਉਹਦੇ ਲਈ ਵੀ ਇੱਕ ਖਾਸ ਉਪਰਾਲਾ ਕੀਤਾ ਹੈ ਕਿ ਸਭ ਨੂੰ ਐਜੂਕੇਸ਼ਨ ਦੇ ਰਹੇ ਹੈ ਕਿ ਉਹ ਜਿਹੜੇ ਫੈਮਿਲੀ ਪਲੈਨਿੰਗ ਹੈ ਉਹਦੇ ਥਰੂਅ ਚੱਲਣ ਤਾਂ ਕਿ ਜਿਹੜੀ ਹੈ ਆਪਾਂ ਜਿਹੜੀ ਜਿਹੜੀ ਵਧਦੀ ਮਹਿੰਗਾਈ ਨੂੰ ਵਧਦੇ ਲੋਕਾਂ ਦੀ ਅ ਮਹੱਤਤਾ ਨੂੰ ਜਿਹੜਾ ਘੱਟ ਕੀਤਾ ਜਾਵੇ ਤਾਂ ਜੋ ਬੱਚ ਬਾਕੀ ਬੱਚਿਆਂ ਦੇ ਵਿੱਚ ਵੀ ਪੜ੍ਹਾਈ ਦਾ ਵਧੀਆ ਅਵਸਰ ਮਿਲੇ ਉਹਨਾਂ ਨੂੰ ਅਤੇ ਤੀਜਾ ਸਭ ਤੋਂ ਵੱਡਾ ਜਿਹੜਾ ਹੈਗਾ ਹੈ ਬੇਰੁਜ਼ਗਾਰੀ ਬੇਰੁਜ਼ਗਾਰੀ ਦੇ ਲਈ ਅੱਜ ਕੱਲ੍ਹ ਜਿਹੜਾ ਹੈ ਸਰਕਾਰ ਨੇ ਕੀ ਕੀਤਾ ਹੈ ਸਭ ਨੂੰ ਕੰਟਰੈਕਟ ਬੇਸਿਸ 'ਤੇ ਨਾ ਜੌਬ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੈ ਤਾਂ ਜੋ ਉਹ ਆਪਣੇ ਘਰ ਦਾ ਕਾਰਗੁਜ਼ਾਰੀ ਕਰ ਸਕੇ ਅਤੇ ਅੱਗੇ ਤੋਂ ਅੱਗੇ ਉਹਨਾਂ ਨੇ ਸਰਕਾਰੀ ਅ ਪੇਪਰਾਂ ਦੇ ਥਰੂਅ ਉਹਨਾਂ ਨੇ ਕੀ ਕੀਤਾ ਹੈ ਕਿ ਜਿਹਨਾਂ ਨੂੰ ਜਿਹੜੇ ਬੱਚੇ ਵਧੀਆ ਪੜ੍ਹਦੇ ਨੇ ਉਹਨਾਂ ਦੇ ਪੇਪਰ ਲੈ ਕੇ ਅੱਗੇ ਉਹਨਾਂ ਨੂੰ ਰੈਗੂਲਰ ਬੇਸਿਸ ਦੇ ਵਿੱਚ ਸਭ ਨੂੰ ਵਧੀਆ ਤਰੀਕੇ ਦੀ ਜੌਬ ਦਿੱਤੀ ਜਾ ਰਹੀ ਹੈ ਅਤੇ ਇਹ ਉਪਰਾਲੇ ਸਭ ਤੋਂ ਵਧੀਆ ਹੋ ਰਹੇ ਹੈ ਇਸ ਭਾਰਤ ਦੇਸ਼ ਦੇ ਵਿੱਚ ਅਤੇ ਬਹੁਤ ਸਾਰੇ ਬੱਚੇ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਹਨ